ਹੈਲੋ ਤੁਸੀਂ ਚਾਚੇ ਦੇ ਢਾਬੇ ਤੋਂ ਗੱਲ ਕਰ ਰਹੇ ਹੋ ਮੈਂ ਅਰਸ਼ਦੀਪ ਸਿੰਘ ਬੋਲ ਰਿਹਾ ਸੀ ਨੇੜੇ ਪੰਜਾਬ ਯੂਨੀਵਰਸਿਟੀ ਕਾਲਜ ਪੰਜਾਬ ਯੂਨੀਵਰਸਿਟੀ ਕਾਲਜ ਬਠਿੰਡਾ ਗੋਬਿੰਦ ਨਗਰ ਤੋਂ ਬੋਲ ਰਿਹਾ ਮੈਂ ਅਤੇ ਮੈਂ ਤੁਹਾਨੂੰ ਓਰਡਰ ਦੇਣਾ ਸੀ ਦਾਲ ਮੱਖਣੀ ਕੜਾਹੀ ਪਨੀਰ ਅਤੇ ਦੋ ਰੁਮਾਲੀ ਰੋਟੀਆਂ ਦਾ ਅਤੇ ਮੈਨ ਹੁਣ ਤਾਂ ਗਿਆਰ੍ਹਾਂ ਵੱਜ ਰਹੇ ਨੇ ਅਤੇ ਮੈਨੂੰ ਚਾਰ ਵਜੇ ਤੱਕ ਓਰਡਰ ਚਾਹੀਦਾ ਸੀ ਵੈਸੇ ਮੈਂ ਅਕਸਰ ਤੁਹਾਡੇ ਤੋਂ ਜਿਹੜਾ ਇਹ ਆਹ ਚੀਜ਼ਾਂ ਮੰਗਵਾਉਂਦਾ ਰਹਿੰਦਾ ਪਿਛਲੇ ਹਫਤੇ ਵੀ ਮੈਂ ਤੁਹਾਡੇ ਤੋਂ ਦਾਲ ਮੱਖਣੀ ਅਤੇ ਕੜਾਹੀ ਪਨੀਰ ਮੰਗਵਾਇਆ ਸੀ ਕਾਫੀ ਹੱਦ ਤੱਕ ਬਹੁਤ ਸਵਾਦ ਬਣਾਇਆ ਹੋਇਆ ਸੀ ਤੁਸੀਂ ਅਤੇ ਅੱਜ ਸਾਡੇ ਘਰ ਕੁਝ ਮਹਿਮਾਨਾਂ ਨੇ ਆਉਣਾ ਉਹ ਚਾਰ ਵਜੇ ਆਉਣਗੇ ਅਤੇ ਮੈਂ ਚਾਹੁੰਦਾ ਸੀਗਾ ਕਿ ਜੇ ਤੁਸੀਂ ਉਹੀ ਚਾਰ ਤਿੰਨ ਜਾਂ ਚਾਰ ਦੇ ਵਿੱਚ ਵਿੱਚ ਤੁਸੀਂ ਮੇਰੇ ਘਰ ਇਹਨਾਂ ਨੂੰ ਡਿਲੀਵਰ ਕਰ ਦਿਉ ਤਾਂ ਬਹੁਤ ਚੰਗਾ ਹੋਵੇਗਾ ਅਤੇ ਤੁਸੀਂ ਇੱਦਾਂ ਕਰਿਓ ਰੁਮਾਲੀ ਰੋਟੀਆਂ ਦੋ ਦੀ ਜਗ੍ਹਾ ਤੁਸੀਂ ਪੰਜ ਕਰ ਦਿਓ ਕਿਉਂਕਿ ਕੋਈ ਪਤਾ ਨਹੀਂ ਕਿਉਂਕਿ ਇੱਕ ਜਣਾ ਕਿ ਦੋ ਜਣੇ ਆ ਰਹੇ ਆ ਵੈਸੇ ਤਾਂ ਮੇਰਾ ਦੋਸਤ ਆ ਜਿਹੜਾ ਮੇਰੇ ਘਰ ਆ ਰਿਹਾ ਅਤੇ ਜੇ ਦੋ ਜਣੇ ਵੀ ਹੋਏ ਤਾਂ ਪੰਜ ਰੋਟੀਆਂ ਚੱਲ ਜਾਂਦੀਆਂ ਨੇ ਅਤੇ ਮੈਨੂੰ ਇਸ ਬਾਰੇ ਦੱਸ ਦਿਓ ਵੀ ਕਿੰਨਾ ਇਹਦੇ 'ਤੇ ਖਰਚਾ ਆਏਗਾ ਟੋਟਲ ਅਤੇ ਤੁਹਾਡਾ ਡ ਡਿਲੀਵਰੀ ਚਾਰਜ ਕਿੰਨਾ ਹੈ ਇਹਨਾਂ ਦਾ ਪਹੁੰਚਾਉਣ ਦਾ ਅਤੇ ਤੁਸੀਂ ਬਸ ਤਿੰਨ ਤੋਂ ਚਾਰ ਦੇ ਵਿੱਚ ਵਿੱਚ ਪਹੁੰਚਾ ਦਿਓ ਅਤੇ ਤੁਸੀਂ ਮੈਨੂੰ ਜਦੋਂ ਮਤਲਬ ਕਾਲ ਕਰ ਦਿਓ ਤੁਹਾਨੂੰ ਪਤਾ ਹੀ ਆ ਮੇਰੇ ਘਰ ਦਾ ਰਸਤਾ ਤਾਂ ਅਤੇ ਬਾਕੀ ਹੋਰ ਕੁਛ ਤੁਹਾਨੂੰ ਜਾਣਕਾਰੀ ਚਾਹੀਦੀ ਹੋਊਗੀ ਤਾਂ ਤੁਸੀਂ ਮੇਰੇ ਨੰਬਰ 'ਤੇ ਦੁਬਾਰਾ ਕਾਲ ਕਰ ਲਿਓ ਅਤੇ ਘਰ ਪਹੁੰਚ ਕੇ ਮੈਨੂੰ ਇੱਕ ਵਾਰੀ ਫਿਰ ਕਾਲ ਕਰ ਦਿਓ ਅਤੇ ਘਰ ਜੇ ਮੈਂ ਨਾ ਹੋਇਆ ਤਾਂ ਕੋਈ ਹੋਏਗਾ ਤਾਂ ਤੁਸੀਂ ਉਹਨੂੰ ਫੜਾ ਦਿਓ ਸਮਾਨ ਥੈਂਕ ਯੂ